ਵੈਸੇ ਤਾਂ ਹਰ ਖੇਡ ਹੀ ਅਵੱਲੀ ਹੁੰਦੀ ਹੈ ਨਵੀਨਤਮ ਹੁੰਦੀ ਹੈ ਅਰਥ ਪੂਰਨ ਹੁੰਦੀ ਹੈ ਭਾਵਨਾ ਹਰ ਖੇਡ ਵਿੱਚ ਜੁੜੀ ਹੁੰਦੀ ਹੈ ਅਤੇ ਪ੍ਰਭਾਵਸ਼ਾਲੀ ਹੁੰਦੀ ਹੈ ਅਜਿਹੀ ਹੀ ਖੇਡ ਹੈ ਇੱਕ ਜਿਸ ਤੋਂ ਮੈਂ ਬਹੁਤ ਹੀ ਪ੍ਰਭਾਵਿਤ ਹੋਇਆ ਹਾਂ ਅਤੇ ਭਾਵਨਾ ਵੀ ਜੁੜੀ ਹੈ ਉਹ ਹੈ ਪਿੱਠੂ ਗਰਮ ਪਿੱਠੂ ਗਰਮ ਜਿਹਦੇ ਵਿੱਚ ਕਿ ਆਪਾਂ ਲੱਕ ਸੇਕਦੇ ਹਾਂ ਖੇਡ ਨਾਲ ਗੇਂਦ ਦੇ ਨਾਲ ਜਦੋਂ ਤੱਕ ਉਹ ਗੀਟੀਆਂ ਗਟੀਆਂ ਇਕੱਠੀਆਂ ਨਹੀਂ ਕਰ ਦਿੰਦਾ ਧਾਤਾਂ ਲੱਕ ਸੇਕੀ ਦੇ ਆ ਉਹਦੇ ਵਿੱਚ ਭਾਵਨਾ ਹੀ ਹੈ ਕਿ ਸਾਨੂੰ ਜਿਹੜਾ ਲੱਕ ਨਾ ਥੋੜ੍ਹਾ ਦੂਜਿਆਂ ਦਾ ਹੌਲੀ ਸੇਕਣਾ ਚਾਹੀਦਾ ਵਾ ਪਰ ਨਹੀਂ ਇਹ ਮੌਕਾ ਹੁੰਦਾ ਅਸੀਂ ਪੂਰੇ ਜੋਰ ਨਾਲ ਗੇਂਦ ਮਾਰ ਕੇ ਅਗਲੇ ਦਾ ਲੱਕ ਪੂਰੇ ਤਰ੍ਹਾਂ ਸੇਕਦੇ ਹਾਂ ਤਾਂ ਕਿ ਮਜ਼ਾ ਵੀ ਆਵੇ

ਅਗਲੇ ਦਾ ਲੱਕ ਵੀ ਸਿਕੇ ਪਰ ਸਮ ਕਦੀ ਕਦੀ ਜੋਰ ਦੀ ਵੀ ਵੱਜ ਜਾਂਦੀ ਹੈ ਕਦੀ ਕਿਸੇ ਦੇ ਸਿਰ 'ਤੇ ਵੱਜ ਜਾਂਦੀ ਹੈ ਕਦੀ ਅਜਿਹੀ ਥਾਂ 'ਤੇ ਵੀ ਵੱਜ ਜਾਂਦੀ ਹੈ ਜਿਸ ਨਾਲ ਅੱਗ ਸਾਹਮਣੇ ਵਾਲਾ ਵਿਅਕਤੀ ਬਿਮਾਰ ਹੋ ਸਕਦਾ ਹੈ ਉਹਨੂੰ ਜ਼ਿਆਦਾ ਜ਼ਰੂਰਤ ਤੋਂ ਸੱਟ ਵੀ ਲੱਗ ਸਕਦੀ ਹੈ ਸਾਨੂੰ ਇਸ ਗੱਲ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ ਖੇਡ ਖੇਡ ਵਿੱਚ ਕਿਸੇ ਨਾਲ ਗਲਤ ਨਹੀਂ ਹੋਣਾ ਚਾਹੀਦਾ ਖੇਡ ਨੂੰ ਖੇਡ ਦੇ ਤਰੀਕੇ ਨਾਲ ਹੀ ਖੇਡਿਆ ਜਾਣਾ ਚਾਹੀਦਾ ਹੈ ਧੰਨਵਾਦ